ਹੈਲੋ ਨਮਸਕਾਰ ਜੀ ਮੈਂ ਰਾਜ ਕੁਮਾਰ ਅਰੋੜਾ ਬੋਲ ਰਿਹਾ ਮੈਂ ਨਾ ਮੈਨੂੰ ਪਤਾ ਲੱਗਿਆ ਕਿ ਤੁਸੀਂ ਗੱਡੀਆਂ ਕਿਰਾਏ 'ਤੇ ਦਿੰਦੇ ਹੋ ਮੈਂ ਅਤੇ ਮੇਰੇ ਦੋਸਤ ਨਾ ਕੁਝ ਦੋਸਤ ਅਸੀਂ ਵ੍ਰਿੰਦਾਵਨ ਜਾਣਾ ਚਾਹੁੰਦੇ ਹਾਂ ਜੇ ਮੈਨੂੰ ਦੱਸੋ ਵੀ ਕਿ ਹਿਸਾਬ ਕਿਤਾਬ ਹੈਗਾ ਇਹ ਗੱਡੀ ਕਿਸ ਤਰ੍ਹਾਂ ਕਿਲੋਮੀਟਰ ਇਹਦਾ ਕੀ ਰੇਟ ਹੈਗਾ ਅਤੇ ਸਾਡਾ ਟੂਰ ਚਾਰ ਪੰਜ ਦਿਨਾਂ ਦਾ ਟੂਰ ਹੈਗਾ ਵ੍ਰਿੰਦਾਵਨ ਅਤੇ ਹੈਂਜੀ ਕਿੰਨੇ ਪੈਸੇ ਲੱਗਣਗੇ ਟੋਟਲ ਅਤੇ ਮੈਂ ਗੱਡੀ ਆਪ ਡਰਾਈਵ ਕਰ ਲੈਂਦਾ ਹੁਣ ਦੱਸੋ ਕਿ ਤੁਸੀਂ ਕਿਹੜੀ ਗੱਡੀ ਅਵੇਲੇਬਲ ਕਰਵਾਓਗੇ ਅਤੇ ਮੈਂ ਸਾਡਾ ਅਸੀਂ ਜਿਹੜੇ ਦੋ ਲੇਡੀਜ ਦੋ ਜੈਂਟਸ ਜਾਂ ਇੱਕ ਅੱਧਾ ਬੱਚਾ ਵੀ ਹੋ ਸਕਦਾ ਅਸੀਂ ਇਹ ਪੰਜ ਮੈਂਬਰ ਨੇ ਸਾਨੂੰ ਉਸ ਤਰ੍ਹਾਂ ਦੀ ਗੱਡੀ ਅਵੇਲੇਬਲ ਕਰਵਾਉਣਾ ਜਿਹੜੀ ਵਿੱਚ ਸਾਡੇ ਛੇ ਕੁ ਛੇ ਕੁ ਮੈਂਬਰ ਆ ਜਾਣ ਛੇ ਸੱਤ ਮੈਂਬਰ ਆ ਜਾਣ ਅੰਦਾਜਾ ਇਹ ਤਾਂ ਠੀਕ ਹੈ ਜੀ ਤੇ ਬਸ ਮੈਨੂੰ ਕਿਰਪਾ ਕਰਕੇ ਜਲਦੀ ਦੱਸ ਦੇਣਾ ਅਤੇ ਮਿਹਰਬਾਨੀ